ਅੱਜ ਕੱਲ੍ਹ ਕਈ ਖੇਡਾਂ ਐਦਾਂ ਨੇ ਜਿਨ੍ਹਾਂ ਦੇ ਰੂਲਸ ਕਾਫ਼ੀ ਅੱਪਡੇਟ ਕਰ ਦਿੱਤੇ ਗਏ ਨੇ ਸਭ ਤੋਂ ਲਾਈਕ ਸਭ ਤੋਂ ਅੱਜ ਕੱਲ੍ਹ ਜੋ ਫੇਮਸ ਕ੍ਰਿਕੇਟ ਚਲਦਾ ਪਿਆ ਕ੍ਰਿਕੇਟ ਦੇ ਵਿੱਚ ਕਈ ਰੂਲਸ ਨੇ ਜਿਹੜੇ ਅੱਪਡੇਟ ਕਰ ਦਿੱਤੇ ਗਏ ਨੇ ਹਜੇ ਪਿੱਛੇ ਲਾਸਟ ਟਾਇਮ ਆਪਾਂ ਦੇਖਿਆ ਗਿਆ ਸੀਗਾ ਕਿ ਲਾਸਟ ਟਾਇਮ ਜਿਹੜਾ ਕੈਚ ਕਰਦੇ ਸੀਗੇ ਅਗਰ ਕੈਚ ਕਰਕੇ ਹਾਈ ਮਤਲਬ ਜੰਪ ਲੈ ਕੇ ਕੈਚ ਕਰਦਾ ਆ ਉਹ ਕੈਚ ਹਵਾ 'ਤੇ ਕਰਕੇ ਉਹ ਬੋਂਡਰੀ ਤੋਂ ਲਾਸਟ ਗਿਰਨ ਤੋਂ ਪਹਿਲਾਂ ਉਸ ਬੋਲ ਨੂੰ ਛੱਡ ਕੇ ਦੁਬਾਰਾ ਬੋਂਡਰੀ ਤੋਂ ਬਾਹਰ ਆ ਕੇ ਕੈਚ ਕਰ ਲੈਂਦਾ ਆ ਤਾਂ ਉਹਨੂੰ ਆਊਟ ਮੰਨਿਆ ਗਿਆ ਸੀਗਾ ਅਤੇ ਇੱਦਾਂ ਕਈ ਰੂਲਸ ਨੇ ਜਿਨ੍ਹਾਂ ਨੂੰ ਚੇਂਜ ਵੀ ਕੀਤਾ ਗਿਆ ਆ ਅਤੇ ਉਨ੍ਹਾਂ ਦੇ ਸਾਰੇ ਅੱਪਡੇਟ ਸਾਨੂੰ ਅੱਧੇ ਨਾਲੋਂ ਜ਼ਿਆਦਾ ਸ਼ੋਸ਼ਲ ਮੀਡੀਆ ਐਪ 'ਚ ਮਿਲ ਜਾਂਦੇ ਆ ਠੀਕ ਹੈ ਨਾ ਕਈ ਸ਼ੋਸ਼ਲ ਮੀਡੀਆ ਐਪ ਨੇ ਜਿਨ੍ਹਾਂ ਦੇ ਥਰੂ ਸਾਨੂੰ ਉਹ ਜਾਣਕਾਰੀ ਮਿਲ ਜਾਂਦੀ ਹੈ ਨਿਊਜ਼ ਪੇਪਰ ਤੋਂ ਜਾਣਕਾਰੀ ਮਿਲ ਜਾਂਦੀ ਹੈ ਕੁਛ ਜਾਣਕਾਰੀ ਸਾਨੂੰ ਉਹਦੇ ਟੀ ਵੀ ਪ੍ਰੋਗਰਾਮਸ ਤੋਂ ਮਿਲ ਜਾਂਦੀ ਆ ਅਤੇ ਕਈ ਰੂਲਸ ਦੀ ਇੰਨਫੋਰਮੇਸ਼ਨਸ ਅੱਪ ਟੂ ਡੇਟ ਅੱਪ ਟੂ ਡੇਟ ਸਾਨੂੰ ਸਕੂਲ ਕੋਲਜਸ ਦੇ ਵਿੱਚੋਂ ਦੀ ਜਿੱਦਾਂ ਆਪਾਂ ਗੇਮਸ ਦੇ ਵਿੱਚ ਜਾਈ ਦਾ ਕੋਚਾਂ ਦੇ ਥਰੂ ਮਿਲ ਜਾਂਦੀ ਆ ਸਮਟਾਇਮ ਕਈ ਰੂਲਸ ਇੱਦਾਂ ਹੁੰਦੇ ਸਟਾਟ ਹੋ ਜਾਂਦੇ ਐਹੈ ਸਾਨੂੰ ਸਕੂਲ ਕੋਲਜ ਜਿੱਦਾਂ ਆਪਾਂ ਬੱਚਿਆਂ ਨੂੰ ਗੇਮ ਕਰਾਈ ਦੀ ਹੈ ਜਾਂ ਗੇਮ ਕਰੀ ਦੀ ਆ ਉਹਦੇ ਥਰੂ ਸਾਨੂੰ ਵੀ ਇਨਫਰਮੇਸ਼ਨ ਮਿਲ ਜਾਂਦੀ ਆ ਕਿ ਉਹ ਨਿਯੂ ਰੂਲਸ ਆ ਗਏ ਨੇ ਅੱਪਡੇਟ ਹੋ ਗਏ ਆ ਕਿਉਂਕਿ ਜਦੋਂ ਵੀ ਆਪਾਂ ਕੋਈ ਗੇਮ ਕਰਵਾਉਦੇ ਹੈ ਉਸ ਤੋਂ ਪਹਿਲਾਂ ਸਾਡੇ ਰੂਲਸ ਰੈਗੁਲੇਸ਼ਨਸ ਸਾਰੇ ਡਿਸਾਇਡ ਹੁੰਦੇ ਆ ਅਤੇ ਉਹਦੇ ਥਰੂ ਸਾਨੂੰ ਕਈ ਰੂਲਸ ਨੂੰ ਸਮਝਣ ਨੂੰ ਜਾਂ ਕਈ ਰੂਲਸ ਸਮਝਾਉਣ ਨੂੰ ਸਾਨੁੂੰ ਦੱਸੇ ਜਾਂਦੇ ਕਿ ਸਰਕਾਰਾਂ ਸਾਨੂੰ ਅਡਵਾਂਸ 'ਚ ਰੂਲਸ ਦੱਸ ਦਿੰਦੀ ਹੈਗੀ ਹੈ ਰੂਲਸ ਇੰਪਲੀਮੈਂਟ ਹੋਣੇ ਹੈ ਅਤੇ ਤੁਸੀਂ ਇਸ ਰੂਲ ਦੇ ਅਕੋਡਿੰਗ ਬੱਚਿਆਂ ਨੂੰ ਗੇਮਾਂ ਖਿਡਾਓ